ਆਪਾਂ ਇੱਥੇ ਏਟੀਐੱਮ ਤੋਂ ਪੈਸੇ ਕਢਾਉਣ ਦੀ ਇੱਕ ਵਿਧੀ ਦਾ ਵਰਨਣ ਕਰਾਂਗੇ ਉਸ ਵਿੱਚ ਸਭ ਤੋਂ ਪਹਿਲਾਂ ਏਟੀਐੱਮ ਦੇ ਕਾਰਡ ਨੂੰ ਮਸ਼ੀਨ ਦੀ ਸਲੋਟ ਵਿੱਚ ਰੱਖ ਕੇ ਉੱਥੇ ਕਈ ਆਪਸ਼ਨਾਂ ਆਉਣਗੀਆਂ ਉਹਨਾਂ ਵਿੱਚ ਇੱਕ ਆਪਸ਼ਨ ਵਿਦਡਰਾਲ ਦੀ ਹੋਵੇਗੀ ਜਿਸਦਾ ਮਤਲਬ ਪੈਸੇ ਕਢਾਉਣ ਦਾ ਮਤਲਬ ਹੋਵੇਗਾ ਉਹਨੂੰ ਪ੍ਰੈਸ ਕਰਕੇ ਉੱਥੇ ਕਿੰਨੇ ਪੈਸੇ ਕਢਾਉਣੇ ਹਨ ਇਹ ਆਪਸ਼ਨ ਆਵੇਗੀ ਉਹਨੂੰ ਭਰਨ ਤੋਂ ਬਾਅਦ ਫਿਰ ਮਸ਼ੀਨ ਏਟੀਐੱਮ ਦਾ ਪਿੰਨ ਤੁਹਾਤੋਂ ਮੰਗੇਗੀ ਜਿਸਨੂੰ ਭਰਨ ਤੋਂ ਬਾਅਦ ਅਕਸੈਪਟ ਕਰਕੇ ਦਾ ਬਟਨ ਤੁਸੀਂ ਦੱਬੋਂਗੇ ਉਸ ਤੋਂ ਬਾਅਦ ਮਸ਼ੀਨ ਤੁਹਾਨੂੰ ਪੈਸੇ ਕੱਢ ਕੇ ਦੇ ਦੇਵੇਗੀ